ਮਨੁੱਖ ਦੇ ਜੀਵਨ ਦੇ ਵਾਸਤੇ ਵਾਤਾਵਰਨ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਮਨੁੱਖੀ ਸਿਹਤ ਦੇ ਲਈ ਅਤੇ ਇਸ ਵਾਸਤੇ ਜ਼ਰੂਰੀ ਆ ਕਿ ਅਸੀਂ ਵਾਤਾਵਰਨ ਨੂੰ ਸਾਰੇ ਰਲ ਕੇ ਸਾਫ ਸੁਥਰਾ ਰੱਖੀਏ ਇਸ ਦੀ ਸੰਭਾਲ ਕਰੀਏ ਤਾਂ ਇਹਦੇ ਵਾਸਤੇ ਸਾਨੂੰ ਜਿਹੜੀਆਂ ਪਹਿਲਾਂ ਕਿ ਇਹ ਵਾਤਾਵਰਨ ਦੀ ਜਿਹੜੀ ਆਲੇ ਦੁਆਲੇ ਦੀ ਗੰਦਗੀ ਫੈਲਦੀ ਆ ਉਹ ਸਾਡੇ ਮਨੁੱਖੀ ਸਰੀਰ ਨੂੰ ਲੋਕਾਂ ਨੂੰ ਬਿਮਾਰ ਕਰ ਦਿੰਦੀ ਹੈ ਅਤੇ ਜਿਹਦੇ ਕਰਕੇ ਸਾਡੀ ਸਿਹਤ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਹਦੇ ਨਾਲ ਨਾਲ ਸਾਡੇ ਰਹਿਣ ਸਹਿਣ 'ਤੇ ਵੀ ਅਸਰ ਹੁੰਦਾ ਹੈ ਅਤੇ ਜਿਸ ਕਰਕੇ ਸਾਨੂੰ ਜ਼ਰੂਰੀ ਹੈ ਕਿ ਆਪਣੇ ਆਲੇ ਦੁਆਲੇ ਨੂੰ ਸਾਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਔਰ ਇਹ ਸਾਫ ਸੁਥਰਾ ਰੱਖਣ ਰੱਖਣ ਦੇ ਵਾਸਤੇ ਕਿਵੇਂ ਹੈ ਕਿ ਸਾਨੂੰ ਆਪਸ ਦੇ ਵਿੱਚ ਸੰਭਾਲ ਇਹਦੀ ਰਲ ਮਿਲ ਕੇ ਇਹਦੇ ਵਾਸਤੇ ਸਾਨੂੰ ਸਾਫ ਕਰਨ ਵਾਸਤੇ ਵਧੀਆ ਯਤਨ ਕਰਨੇ ਚਾਹੀਦੇ ਨੇ ਰਲ ਮਿਲ ਕੇ ਇਹਦੇ ਵਾਸਤੇ ਯਤਨ ਜਿਵੇਂ ਸਾਨੂੰ ਪਤਾ ਵੀ ਹੈ ਕਿ ਵੇਖਿਆ ਵੀ ਹੈ ਕਿ ਸਾਡੇ ਸੰਤ ਬਾਬਾ ਸੀਚੇਵਾਲ ਜੀ ਜਿਸ ਤਰ੍ਹਾਂ ਉਹਨਾਂ ਨੇ ਸਾਰੇ ਪਾਸੇ ਦਰੱਖਤ ਵਗੈਰਾ ਲਗਾਏ ਨੇ ਕਿਸ ਤਰ੍ਹਾਂ ਉਹਨਾਂ ਨੂੰ ਸਫਾਈ ਵਾਸਤੇ ਸਾਰੇ ਉਹਨਾਂ ਨੇ ਆਪਣਾ ਪ ਪੰਜਾਬ ਗੌਰਮੈਂਟ ਦੀ ਸਹਾਇਤਾ ਦੇ ਲੈ ਕੇ ਕਿਵੇਂ ਉਹਨਾਂ ਨੇ ਆਪਣਾ ਡਸਟਬੀਨ ਵਗੈਰਾ ਇਹਨਾਂ ਦੇ ਸਾਰੇ ਜਿਹੜੇ ਅਰੇਂਜਮੈਂਟ ਕਰਵਾਏ ਨੇ ਇਸ ਕਰਕੇ ਕਿ ਸਾਨੂੰ ਇਹਦੇ ਵਾਸਤੇ ਸਾਨੂੰ ਯਤਨ ਦੇ ਵਿੱਚ ਅਤੇ ਸਾਨੂੰ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਕਿ ਇਹਦੇ ਵਾਸਤੇ ਜਾਗਰੂਕਤਾ ਦੇ ਵਾਸਤੇ ਅਤੇ ਸਾਨੂੰ ਉਹ ਉਹਦੇ ਵਾਸਤੇ ਸੈਮੀਨਾਰ ਵਗੈਰਾ ਲਗਾਉਣੇ ਚਾਹੀਦੇ ਹਨ ਜਿਹੜੀ ਪਲਾਸਟਿਕ ਜ਼ਿਆਦਾ ਯੂਜ ਹੁੰਦੀ ਹੈ ਵਰਤੀ ਜਾਂਦੀ ਹੈ ਉਹਦੇ 'ਤੇ ਰੋਕ ਲਾਉਣੀ ਚਾਹੀਦੀ ਹੈ ਇਹਦੇ ਨਾਲ ਨਾਲ ਸੈਮੀਨਾਰ ਜਦੋਂ ਅਸੀਂ ਲਗਾਵਾਂਗੇ ਉਹਦੇ ਵਿੱਚ ਸਾਰੇ ਗਰੁੱਪ ਬਣਨਗੇ ਉਹ ਗਰੁੱਪ ਇੱਕ ਦੂਜੇ ਦੇ ਨਾਲ ਸਾਰੇ ਜਿਹੜੇ ਆਪਣੇ ਜਿਹੜੇ ਵਿਚਾਰ ਨੇ ਇਹਦੇ ਵਾਤਾਵਰਨ ਦੀ ਸੰਭਾਲ ਦੇ ਬਾਰੇ ਇੱਕ ਦੂਜੇ ਨੂੰ ਦੱਸਣਗੇ ਸੰਭਾਲ ਕਰਨਗੇ ਅਤੇ ਇਸੇ ਤਰ੍ਹਾਂ ਪਬਲਿਕ ਪਲੇਸਿਸ 'ਤੇ ਜਾ ਕੇ ਇਹਦੇ ਬਾਰੇ ਸਾਰਾ ਜਾਗਰੂਕ ਕਰਨ ਵਾਸਤੇ ਕਿ ਸਾਫ ਸਫਾਈ ਦੀ ਕੀ ਮਹੱਤਤਾ ਹੈ ਇਹਦੇ ਬਾਰੇ ਦੱਸਿਆ ਜਾਣਾ ਚਾਹੀਦਾ ਹੈ